ਸਾਡੇ ਖੇਤਰ ਦੇ ਕੁਦਰਤੀ ਸਰੋਤ ਕਾਫੀ ਹਨ ਜਿਨ੍ਹਾਂ ਵਿੱਚੋਂ ਕੁਛ ਮੈਂ ਤੁਹਾਨੂੰ ਦੱਸਦਾ ਜਿਵੇਂ ਕਿ ਰੇਤ ਬਜਰੀ ਜੋ ਕਿ ਬਿਲਡਿੰਗ ਮਟੀਰੀਅਲ ਦਾ ਕਾਫੀ ਇਸ ਤੋਂ ਬਿਨਾ ਬਿਲਡਿੰਗ ਤਿਆਰ ਹੀ ਨਹੀਂ ਹੋ ਸਕਦੀ ਵਪਾਰ ਦਾ ਇੱਕ ਚੰਗਾ ਸੋਮਾ ਵਾ ਪਾਣੀ ਹੋਰ ਜਿਵੇਂ ਕਿ ਬਾਗਬਾਨੀ ਦਾ ਚੰਗਾ ਏ ਜਿਹਦੇ ਤੋਂ ਆਪਾਂ ਨੂੰ ਚੰਗੀ ਹਵਾ ਮਿਲਦੀ ਆ ਇੱਕ ਇਹ ਕੁਦਰਤੀ ਸਰੋਤ ਹੀ ਆਪਾਂ ਕਹਿ ਸਕਦੇ ਹਾਂ ਹੋਰ ਮਿੱਟੀ ਮਿੱਟੀ ਦਾ ਵੀ ਵਪਾਰਕ ਤੌਰ 'ਤੇ ਆਪਾਂ ਲੈ ਸਕਦੇ ਹਾਂ ਪਾਣੀ ਪੰਜ ਦਰਿਆਵਾਂ ਦੀ ਧਰਤੀ ਆ ਇੱਥੋਂ ਆਪਾਂ ਬਿਜਲੀ ਦੇ ਚੰਗੇ ਪ੍ਰੋਡਕਟ ਲੱਗੇ ਆ ਅਤੇ ਜਿਸ ਤੋਂ ਬਿਜਲੀ ਤਿਆਰ ਕਰਦੇ ਹਾਂ ਬਿਜਲੀ ਬਾਹਰ ਦੇ ਖੇਤਰਾਂ ਨੂੰ ਦਿੱਤੀ ਜਾਂਦੀ ਆ ਅਤੇ ਸਾਡੇ ਰਾਜ ਦਾ ਕਮਾਈ ਦਾ ਇੱਕ ਚੰਗਾ ਇਹ ਜ਼ਰੀਆ ਵਾ ਸਾਧਨ ਆ